ਮਹਿੰਗਾਈ ਦੀ ਸਮੱਸਿਆ ਇਹੀ ਹੈ ਕਿ ਏਸੀ ਤੋਂ ਅਸੀਂ ਪਰੇਸ਼ਾਨ ਹੋ ਚੁੱਕੇ ਹਾਂ ਕਿ ਏਸੀ ਬਿਨਾਂ ਅਸੀਂ ਰਹਿ ਵੀ ਨਹੀਂ ਸਕਦੇ ਰਹਿੰਦੇ ਹਾਂ ਤਾਂ ਰੋਗਾਂ ਤੋਂ ਰੋਗਾਂ ਦੇ ਵਿੱਚ ਵੜਦੇ ਜਾ ਰਹੇ ਹਾਂ ਹਰ ਇਨਸਾਨ ਨੂੰ ਅੱਜ ਕੱਲ੍ਹ ਰੋਗ ਹੀ ਰੋਗ ਨੇ ਰੋਗ ਹੀ ਰੋਗ ਨੇ ਬਾਕੀ ਇਹ ਹੈ ਕਿ ਅੱਜ ਕੱਲ੍ਹ ਇੰਟਰਨੈਟ ਦੀ ਸਪੀਡ ਹੈ ਜੋ ਦੇਖਿਆ ਜਾਵੇ ਕਿ ਵਾਈਫਾਈ ਵਾਈਫਾਈ ਘਰ ਘਰ ਲੱਗਿਆ ਹੋਇਆ ਹੈ ਲੇਕਿਨ ਇਸ ਨਾਲ ਕੀ ਹੁੰਦਾ ਹੈ ਕਿ ਅਸੀਂ ਬ ਨੈੱਟ ਤਾਂ ਬਹੁਤ ਅੱਛਾ ਚਲਾ ਰਹੇ ਹਾਂ ਲੋਕ ਵੀ ਚਲਾ ਰਹੇ ਨੇ ਆਸ ਪੜੋਸ ਵੀ ਚਲਾ ਰਹੇ ਨੇ ਲੇਕਿਨ ਇਹਦੇ ਨਾਲ ਕੀ ਹੈ ਇਹਦੇ ਨਾਲ ਸਮੱਸਿਆਵਾਂ ਇਹ ਨੇ ਕਿ ਸਾਡੇ ਜੀਵਨ ਵਿੱਚ ਪਕਸ਼ੀਆਂ ਦੀ ਕਮੀ ਬਹੁਤ ਜ਼ਿਆਦਾ ਹੋ ਗਈ ਹੈ ਕਿਉਂਕਿ ਰੇਜ਼ ਨਾਲ ਜਦੋਂ ਰੇਜ਼ ਫਿਰਦੀ ਹੈ ਅਤੇ ਉਸ ਟਾਈਮ ਪ ਪਕਸ਼ੀ ਵਿੱਚ ਆ ਜਾਂਦੇ ਨੇ ਫਿਰ ਤਾਰਾਂ ਡਰਦੇ ਨੇ ਉਹਨਾਂ ਦੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਅੱਗੇ ਅਸੀਂ ਦੇਖਦੇ ਸੀ ਚੀ ਸ਼ਾਮ ਸਵੇਰੇ ਦੋਨੋਂ ਟਾਈਮ ਪਕਸ਼ੀਆਂ ਦਾ ਸਮਾਂ ਹੁੰਦਾ ਸੀ ਚੀਂ ਚੀਂ ਕਰਦੀ ਚਿੜੀਆਂ ਬਾਹਰ ਆ ਗਈਆਂ ਅੰਦਰ ਗਈਆਂ ਸੁਬਹ ਵੀ ਚਾਰ ਵਜਦੇ ਸਾਢ਼ੇ ਚਾਰ ਵਜਦੇ ਪਕਸ਼ੀਆਂ ਦੀਆਂ ਚਹਿਚਹਾਉਣਾ ਸ਼ੁਰੂ ਕਰ ਦੇਣਾ ਹੈ ਨਾ ਲੇਕਿਨ ਅੱਜ ਕੱਲ੍ਹ ਦੇਖਦੇ ਹਾਂ ਅਨੁਸਾਰ ਨੈਟਵਰਕ ਦੇ ਵਾਈਫਾਈ ਦੇ ਕਾਰਨ ਲੋਕ ਪਕਸ਼ੀਆਂ ਨੂੰ ਸੁਣ ਵੀ ਨਹੀਂ ਸਕਦੇ ਕਿ ਇੰਨੇ ਪਕਸ਼ੀ ਘੱਟ ਹੋ ਚੁੱਕੇ ਨੇ ਮਤਲਬ ਜੋ ਵੀ ਹੈ ਇਹ ਸਮੱਸਿਆ ਹੀ ਹੈ ਕਿ ਜਿਹੜੀ ਕਿ ਅਸੀਂ ਡਾਟਾ ਡਾਟਾ ਕਰਦੇ ਰਹਿੰਦੇ ਹਾਂ ਲੇਕਿਨ ਡਾਟਾ ਕੋਈ ਚੰਗੀ ਚੀਜ਼ ਨਹੀਂ ਹੈ ਇਹ ਮਾੜੀ ਚੀਜ਼ ਹੀ ਹੈ